ਹਾਂ ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਸਿਹਤ ਸੰਭਾਲ ਤੱਕ ਪਹੁੰਚ ਨੂੰ ਖ਼ਾਸ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਖ਼ਾਸ ਕਰਕੇ ਪੇਂਡੂ ਜਾਂ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਜਦੋਂ ਆਵਾਜਾਈ ਦੇ ਵਿਕਲਪ ਸੀਮਤ ਹੁੰਦੇ ਹਨ ਤਾਂ ਮਰੀਜ਼ ਸਿਹਤ ਸੰਭਾਲ ਸਹੂਲਤਾਂ ਤਕ ਪਹੁੰਚਣ ਲਈ ਸੰਘਰਸ਼ ਕਰ ਸਕਦੇ ਹਨ ਜਿਸ ਨਾਲ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਦੇਰੀ ਹੋ ਸਕਦੀ ਹੈ ਅਤੇ ਸਿਹਤ ਦੇ ਨਤੀਜੇ ਵਿਗੜ ਸਕਦੇ ਹਨ ਉਹਨਾਂ ਖੇਤਰਾਂ ਵਿੱਚ ਜਿੱਥੇ ਹਸਪਤਾਲ ਭਾਈਚਾਰਿਆਂ ਤੋਂ ਦੂਰ ਸਥਿਤ ਹਨ ਸਮੱਸਿਆ ਹੋਰ ਵੱਧ ਗਈ ਹੈ ਕਿਉਂਕਿ ਵੱਕ ਵਿਅਕਤੀਆਂ ਨੂੰ ਲੋੜੀਦੀਆਂ ਸੇਵਾਵਾਂ ਤੱਕ ਪਹੁੰਚਣ ਲਈ ਲੰਬੀਆਂ ਯਾਤਰਾਵਾਂ ਅਤੇ ਉੱਚ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਥਿਤੀ ਪਹੁੰਚ ਯੋਗਤਾ ਨੂੰ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਬਿਹਤਰ ਆਵਾਜਾਈ ਬੁਨਿਆਦੀ ਢਾਂਚੇ ਅਤੇ ਮੋਬੈਲ ਸਿਹਤ ਸੇਵਾਵਾਂ ਦੀ ਲੋੜ ਨੂੰ ਰੇਖਾਕ੍ਰਿਤ ਕਰਦੀ ਹੈ ਕੀ ਸਾਰੇ ਵਿਅਕਤੀ ਭਾਵੇਂ ਉਹਨਾਂ ਦਾ ਸਥਾਨ ਕੋਈ ਵੀ ਹੋਵੇ ਸਮੇਂ ਸਿਰ ਅਤੇ ਲੋੜੀਂਦੀ ਸਿਹਤ ਸੰਭਾਲ ਪ੍ਰਾਪਤ ਕਰ ਸਕਦੇ ਹਨ